ਯਾਨੀ ਕਿ ਭਾਰਤ ਦੀ ਜਨਸੰਖਿਆ ਜਿਹੜੀ ਹੈ ਐਂਤਕੀ ਪਹਿਲੇ ਨੰਬਰ ਪਾ ਆ ਗਈ ਉਹਦੇ ਕਰਕੇ ਦੇਖਿਆ ਜਾਵੇ ਰੁਜ਼ਗਾਰ ਦੀ ਮੰਗ ਬਹੁਤ ਵੱਧ ਗਈ ਜਨਸੰਖਿਆ ਵੱਧਣ ਕਰਕੇ ਫਿਰ ਦਿਨ ਪਰ ਦਿਨ ਗਾਹਾਂ ਨੌਕਰੀਆਂ ਦਾ ਬਾਈ ਘੱਟ ਹੀ ਰਹੀਆਂ ਜੇ ਨੌਕਰੀ ਬਜ਼ਾਰ ਦਾ ਹਾਲ ਦੇਖਿਆ ਜਾਵੇ ਬਹੁਤ ਚੰਗਾ ਨਹੀਂ ਹੈ ਕਿਉਂਕਿ ਹਰੇਕ ਹੀ ਚੱਕ ਕੇ ਮੂੰਹ ਨੌਕਰੀ ਲੱਗਣ ਦੀ ਦੇਖ ਰਿਹਾ ਵੀ ਐਂ ਨੀ ਦੇਖ ਰਿਹਾ ਵੀ ਕੋਈ ਕਾਰੋਬਾਰ ਦੇਖੀਏ ਜਾਂ ਕੋਈ ਕਦੇ ਚਾਰ ਬੰਦੇ ਨੂੰ ਨੌਕਰੀ ਪਾ ਗਾਹਾਂ ਰੱਖੀਏ ਸਭ ਦੀ ਸੋਚ ਹੀ ਅਸਲ 'ਚ ਇੱਥੇ ਕੁ ਤੱਕ ਬਣਾ ਦਿੱਤੀ ਵੀ ਨੌਕਰੀ ਲੱਗਣਾ ਜੇ ਦੇਖਿਆ ਜਾਵੇ ਇਸ ਸਮੇਂ ਤਾਂ ਸਭ ਤੋਂ ਬੜੀਆਂ ਚੁਣੌਤੀਆਂ ਇਹ ਹੀ ਹੈ ਵੀ ਜਨਸੰਖਿਆ ਬਹੁਤ ਹੈ ਜਾਣੀ ਕਿ ਮੁਕਾਬਲਾ ਬਹੁਤ ਹੈ ਇੱਕ ਇੱਕ ਨੌਕਰੀ ਪਿੱਛੇ ਹਜ਼ਾਰ ਹਜ਼ਾਰ ਲੋਕ ਭਰ ਦਿੰਦੇ ਫਾਰਮ ਫਿਰ ਉੱਥੇ ਤਾਂ ਦੇਖ ਲਉ ਹੁਣ ਕਿੰਨਾ ਕੁ ਬਣਦਾ ਵੀ ਨੌਕਰੀ ਮਿਲ ਜਾਉ ਅਤੇ ਉਹ ਤੇ ਇਲਾਵਾ ਬਾਕੀ ਐਂ ਵੀ ਹੈਗਾ ਕੁਛ ਵੀ ਸਾਡੇ ਜਾਣੀ ਕਿ ਉਹ ਜਾਣਕਾਰੀ ਹੁੰਦੀ ਉਹ ਨਹੀਂ ਜਿਹੜੀ ਕਿਸੇ ਨੌਕਰੀ ਲਈ ਚਾਹੀਦੀ ਹੁੰਦੀ ਹੈ ਕਈ ਵਾਰੀ ਨੌਕਰੀਆਂ ਹੀ ਹੋਰ ਹੀ ਹੋਰ ਹੀ ਚੀਜ਼ ਨਿਕਲੀ ਜਾਂਦੀਆ ਸਾਨੂੰ ਪਤਾ ਹੋਰ ਕੁਛ ਹੁੰਦਾ ਹੈ ਜਾਣੀ ਕਿ ਆਪਾਂ ਉਹ ਨੌਕਰੀ ਦੇ ਕਾਬਲ ਹੀ ਨਹੀਂ ਬਣ ਪਾਉਂਦੇ ਉਹ ਤੋਂ ਇਲਾਵਾ ਫਿਰ ਜੇ ਦੇਖਿਆ ਜਾਵੇ ਮੌਕੇ ਤਾਂ ਇਸ ਟਾਈਮ ਭਾਰਤ ਸਰਕਾਰ ਮੌਕੇ ਬਹੁਤ ਦੇ ਰਹੀ ਹੈ ਭਾਰਤ ਸਰਕਾਰ ਜਾਣੀ ਕਿ ਬਹੁਤ ਤਰ੍ਹਾਂ ਦੇ ਲੋਨ ਦੇ ਰਹੀ ਕਾਰੋਬਾਰਾਂ ਚਲਾਉਣ ਦੇ ਲਈ ਜੇ ਬੰਦੇ ਜੁੜਨਗੇ ਉਹਨਾਂ ਦੇ ਨਾਲ਼ ਲੋਨ ਲੂਨ ਚੱਕ ਕੇ ਕਾਰੋਬਾਰ ਚਲਾਉਣਗੇ ਤਾਂ ਇਹ ਪੱਕਾ ਹੈ ਵੀ ਗਾਹਾਂ ਉਹ ਬੰਦੇ ਚਾਰ ਨੌਕਰੀ ਪਾ ਰੱਖਣਗੇ ਸੋ ਇੱਦਾਂ ਆਪਾਂ ਦੇਖ ਸਕਦੇ ਹਾਂ ਵੀ ਮੌਕੇ ਬਹੁਤ ਹੈ ਨੌਕਰੀਆਂ ਵਧਾਉਣ ਦੇ ਬਸ ਜਾਣੀ ਕਿ ਬਾਕੀ ਸੋਚ ਸਭ ਦੀ ਆਪੋ ਆਪਣੀ ਹੈ ਵੀ ਕੋਈ ਕਿੱਧਰ ਨੂੰ ਚੱਲਦਾ ਕੋਈ ਕਿੱਧਰ ਨੂੰ ਚੱਲਦਾ